ਇਹ ਚੀਜ਼ ਮਹਿਮਾਨ ਦੇ ਉੱਤੇ ਡਿਪੈਂਡ ਕਰਦੀ ਆ ਵੈਸੇ ਤਾਂ ਅਸੀਂ ਚਾਹ ਵਰਤਾਉਂਦੇ ਹਾਂ ਅਤੇ ਚਾਹ ਦੇ ਨਾਲ ਘਰ ਦੇ ਬਣੇ ਹੋਏ ਬਿਸਕੁਟ ਰੱਖਦੇ ਹਾਂ ਜਾਂ ਘਰ ਦੀਆਂ ਬਣੀਆਂ ਹੋਈਆਂ ਮੱਠੀਆਂ ਰੱਖਦੇ ਹਾਂ ਜੇ ਕੋਈ ਬਾਹਲ਼ਾ ਹੀ ਬਾਹਰਲਾ ਖਾਣਾ ਪਸੰਦ ਕਰਦਾ ਤਾਂ ਉਹਨੂੰ ਬਾਹਰਲਾ ਖਾਣਾ ਵੀ ਮੰਗਵਾ ਕੇ ਦਿੰਦੇ ਹਾਂ